ਸਤਿ ਸ਼੍ਰੀ ਅਕਾਲ ਜੀ ਤੁਸੀਂ ਇਛਾਪੜਾ ਰੈਸਟੋਰੈਂਟ ਤੋਂ ਬੋਲ ਰਹੇ ਹੋ ਅਸੀਂ ਸਵਿਗੀ ਐਪ ਤੋਂ ਖਾਣਾ ਆਰਡਰ ਕੀਤਾ ਸੀ ਤੁਹਾਡਾ ਖਾਣਾ ਬਹੁਤ ਹੀ ਵਧੀਆ ਹੁੰਦਾ ਅਤੇ ਇਸ ਵਾਰ ਖਾਣਾ ਜਲਦੀ ਨਹੀਂ ਪਹੁੰਚ ਪਾਇਆ ਅਤੇ ਬਹੁਤ ਹੀ ਜ਼ਿਆਦਾ ਦੇਰ ਲਗਾ ਦਿੱਤੀ ਬਟ ਤੁਹਾਡਾ ਖਾਣਾ ਬਹੁਤ ਹੀ ਵਧੀਆ ਹੁੰਦਾ ਹੈ ਖਾਣ 'ਚ ਵੀ ਬਹੁਤ ਟੇਸਟੀ ਹੁੰਦਾ ਹੈ ਅਤੇ ਇਸ ਕਰਕੇ ਪਤਾ ਨਹੀਂ ਇਸ ਵਾਰ ਕਿਉਂ ਇੰਨੀ ਦੇਰ ਲਗਾ ਦਿੱਤੀ ਤੁਸੀਂ ਸਾਨੂੰ ਇਸਦਾ ਕਾਰਨ ਦੱਸੋ ਵੀ ਇੰਨੀ ਦੇਰ ਕਿਉਂ ਲਗਾ ਦਿੱਤੀ ਪਹਿਲਾਂ ਤਾਂ ਕਦੇ ਲੇਟ ਹੋਇਆ ਹੀ ਨਹੀਂ ਸੀ ਖਾਣਾ ਇਸ ਵਾਰ ਬਹੁਤ ਜ਼ਿਆਦਾ ਲੇਟ ਹੋ ਗਿਆ ਇਸ ਦਾ ਕਾਰਨ ਸਾਨੂੰ ਦੱਸਿਆ ਜਾਵੇ ਵੀ ਇਸ ਵਾਰ ਇੰਨੀ ਲੇਟ ਕਿਉਂ ਕਰ ਦਿੱਤਾ ਖਾਣਾ